ਸਤਿ ਸ਼੍ਰੀ ਅਕਾਲ ਮੈਂ ਪ੍ਰੀਆ ਅੱਜ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਜੋ ਮੇਰੇ ਨਾਲ ਅੱਜ ਬੀਤੀ ਅੱਜ ਮੇਰੇ ਭਰਾ ਦਾ ਜਨਮ ਦਿਨ ਸੀ ਅਤੇ ਮੈਂ ਲੋਕਲ ਜਦੋਂ ਦੁਕਾਨਾਂ 'ਤੇ ਨਾ ਜਾ ਕੇ ਸਵੀਗੀ ਤੋਂ ਇੱਕ ਚੀਜ਼ ਔਡਰ ਕੀਤੀ ਸੀ ਮੇਰੇ ਭਰਾ ਨੂੰ ਰਸ ਮਲਾਈ ਬਹੁਤ ਪਸੰਦ ਹੈ ਅਤੇ ਮੈਂ ਉਹ ਸਵੀਗੀ ਤੋਂ ਔਡਰ ਕਰ ਲਈ ਕਿਉਂਕਿ ਮੇਰੇ ਕੋਲ ਸਮਾਂ ਘੱਟ ਹੋਣ ਕਰਕੇ ਮੈਂ ਲੋਕਲ ਦੁਕਾਨਾਂ 'ਤੇ ਜਾ ਕੇ ਉੱਥੋਂ ਸਮਾਨ ਨਹੀਂ ਸੀ ਲਿਆ ਸਕਦੀ ਕਿਉਂਕਿ ਮੈਨੂੰ ਹੋਰ ਬਹੁਤ ਸਾਰੇ ਕੰਮ ਸਨ ਪਰ ਕੀ ਹੋਇਆ ਮੈਂ ਜਦੋਂ ਬਾਕੀ ਕੰਮ ਨਿਬੇੜ ਕੇ ਸਵੀਗੀ ਵਾਲੇ ਔਡਰ ਦਾ ਇੰਤਜ਼ਾਰ ਕੀਤਾ ਤਾਂ ਮੈਨੂੰ ਬਹੁਤ ਜ਼ਿਆਦਾ ਇੰਤਜ਼ਾਰ ਕਰਨਾ ਪੈ ਗਿਆ ਇਸ ਨਾਲ ਕੀ ਹੋਇਆ ਕਿ ਸਾਡੇ ਪੂਰੇ ਘਰ ਦਾ ਜਿਹੜਾ ਮੂਡ ਸੀ ਉਹ ਥੋੜ੍ਹਾ ਫਿੱਕਾ ਪੈ ਗਿਆ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਔਡਰ ਮਿਲਿਆ ਅਤੇ ਉਹਦੀ ਉਹ ਦੀ ਪੈਕਿੰਗ ਥੋੜ੍ਹੀ ਚਿਪਚਿਪੀ ਜਿਹੀ ਲੱਗੀ ਮੈਨੂੰ ਜਦੋਂ ਮੈਂ ਦੇਖਿਆ ਤਾਂ ਮੈਨੂੰ ਕੁਝ ਗੜਬੜ ਜਿਹੀ ਜਾਪੀ ਮੈਂ ਫਿਰ ਉਸ ਪੈਕਿੰਗ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਿੱਦਾਂ ਹੀ ਮੈਂ ਉਸ ਪੈਕਿੰਗ ਨੂੰ ਖੋਲ੍ਹਿਆ ਤਾਂ ਕੀ ਹੋਇਆ ਉਹ ਸਾਰਾ ਹੀ ਲੀਕ ਕਰ ਰਿਹਾ ਸੀ ਜਿੱਦਾਂ ਉਹ ਲੀਕ ਕਰਦਾ ਹੋਇਆ ਕੀ ਹੋਇਆ ਮੇਰੇ ਕੱਪੜਿਆਂ 'ਤੇ ਪੈ ਗਿਆ ਅਤੇ ਮੇਰੇ ਸਾਰੇ ਨਵੇਂ ਕੱਪੜੇ ਜਿਹੜੇ ਸੀ ਉਹ ਖ਼ਰਾਬ ਹੋ ਗਏ ਅਤੇ ਸਾਹ ਨਾਲ ਹੀ ਉਹ ਸਾਰਾ ਨੀਚੇ ਖਿੱਲਰ ਗਿਆ ਜਿਸ ਨਾਲ ਮੇਰੇ ਜਿਸ ਭਰਾ ਦਾ ਬਰਡੇ ਸੀ ਉਹਦਾ ਵੀ ਮੂਡ ਖ਼ਰਾਬ ਹੋ ਗਿਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਮੈਂ ਕਿ ਮੈਂ ਵਿਕਰੇਤਾ ਅਤੇ ਡਿਲੀਵਰੀ ਕੰਪਨੀ ਤੱਕ ਆਪਣੀ ਗੱਲ ਪਹੁੰਚਾਉਣਾ ਚਾਹੁੰਦੀ ਹਾਂ ਜਾਂ ਤਾਂ ਇਸ ਸਮਾਨ ਨੂੰ ਬਦਲੀ ਕੀਤਾ ਜਾਏ ਜਾਂ ਫਿਰ ਮੇਰੇ ਪੈਸਿਆਂ ਨੂੰ ਰਿਫੰਡ ਕੀਤਾ ਜਾਏ